ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਕੰਪਨੀ ਦਾ ਨਾਮ ਹੈ ਅੰਮ੍ਰਿਤਸਰ ਇੰਟੀਰੀਅਰ ਡਿਜ਼ਾਇਨਿੰਗ ਅਸੀਂ ਲਗਭਗ ਚਾਲੀ ਕਰੋੜ ਦਾ ਬਿਜ਼ਨਸ ਪਿਛਲੇ ਦੋ ਸਾਲਾਂ 'ਚ ਕੀਤਾ ਹੈ ਅਤੇ ਅਸੀਂ ਲਗਭਗ ਡੇਢ ਸੌ ਘਰਾਂ ਦੇ ਵਿੱਚ ਇੰਟੀਰੀਅਰ ਡਿਜ਼ਾਇਨਿੰਗ ਕਰ ਚੁੱਕੇ ਹਾਂ ਸੋ ਮੈਮ ਇੰਟੀਰੀਅਰ ਡਿਜ਼ਾਇਨਿੰਗ ਤੋਂ ਪਹਿਲੇ ਮੈਂ ਤੁਹਾਨੂੰ ਕੁਛ ਫੈਕਟਰ ਦੱਸਣਾ ਚਾਹਵਾਂਗਾ ਜਿਹੜੇ ਜਿਹੜੇ ਚੀਜ਼ਾਂ ਕਰਕੇ ਆਪਾਂ ਇੰਟੀਰੀਅਰ ਡਿਜ਼ਾਇਨਿੰਗ ਘਰ ਵਿੱਚ ਕਰ ਸਕਦੇ ਹਾਂ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਫੈਕਟਰ ਹੈ ਲਾਈਟਨਿੰਗ ਘਰ ਦੀ ਜਿਹੜੀ ਰੌਸ਼ਨੀ ਹੈ ਇਹਦੇ ਵਾਸਤੇ ਮੈਂ ਤੁਹਾਡੀ ਇੱਕ ਵਾਰੀ ਰਿਕੁਇਰਮੈਂਟ ਪੁੱਛ ਹਾਂਜੀ ਇਹਦੇ ਵਾਸਤੇ ਮੈਂ ਤੁਹਾਡੇ ਕੋਲ ਰਿਕੁਆਇਰਮੈਂਟ ਪੁੱਛਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਘਰ ਦੇ ਵਿੱਚ ਜਿਹੜੇ ਓਪਨ ਏਰੀਆਜ ਹੈਗੇ ਨੇ ਜਿੱਥੋਂ ਤੁਹਾਡੇ ਘਰ ਵਿੱਚ ਧੁੱਪ ਐਂਟਰ ਹੁੰਦੀ ਹੈ ਜਿਵੇਂ ਤੁਹਾਡੀਆਂ ਖਿੜਕੀਆਂ ਤੁਹਾਡੇ ਘਰ ਵਿੱਚ ਕੋਈ ਓਪਨ ਡੱਕਟ ਹੈ ਜਾਂ ਕੋਈ ਮੁੱਗ ਹੈ ਉਸਦੀ ਲੋਕੇਸ਼ਨ ਕੀ ਹੈ ਹਾਂਜੀ ਅੱਛਾ ਜੀ ਠੀਕ ਹੈ ਮੈਡਮ ਠੀਕ ਹੈ ਮੈਡਮ ਮੈਂ ਸਮਝ ਗਿਆ ਦੂਜਾ ਫੈਕਟਰ ਜਿਹੜਾ ਇੰਟੀਰੀਅਰ ਡਿਜ਼ਾਇਨਿੰਗ ਵਿੱਚ ਸਾਨੂੰ ਚਾਹੀਦਾ ਹੁੰਦਾ ਹੈ ਉਹ ਹੈ ਕਲਰ ਸਕੀਮ ਦੇਖੋ ਮੈਮ ਜ ਕਲਰ ਸਕੀਮ ਇਸ ਤਰੀਕੇ ਨਾਲ ਡਿਪੈਂਡ ਕਰਦੀ ਹੈ ਕਿ ਜਿਹੜੇ ਬੈਡਰੂਮ ਹੈਗੇ ਨੇ ਉਹਨਾਂ ਵਿੱਚ ਆਪਾਂ ਜਿਹੜੇ ਆ ਡਾਰਕ ਕਲਰਸ ਲਗਾਉਂਦੇ ਹਾਂ ਅਤੇ ਜਿਹੜੇ ਲਿਵਿੰਗ ਏਰੀਆ ਹੁੰਦੇ ਨੇ ਜਿਨਾਂ ਵਿੱਚ ਆਪਾਂ ਆਮ ਤੌਰ 'ਤੇ ਜ਼ਿਆਦਾਤਰ ਰਹਿੰਦੇ ਹਾਂ ਅਤੇ ਕਿਚਨ ਜਿੱਥੇ ਆਪਾਂ ਜ਼ਿਆਦਾਤਰ ਖਾਣਾ ਪਕਾਉਂਦੇ ਹਾਂ ਉਹ ਏਰੀਆ ਨੂੰ ਲਾਈਟ ਕਲਰ ਦਿੱਤੇ ਜਾਂਦੇ ਹਨ ਅਤੇ ਜਿਹੜੇ ਗੂੜ੍ਹੇ ਰੰਗ ਹਨ ਉਹ ਆਪਾਂ ਬੈਡਰੂਮ ਵਿੱਚ ਦਿੰਦੇ ਹਾਂ ਠੀਕ ਹੈ ਮੈਡਮ ਕਿਚਨ ਮੈਮ ਤੁਹਾਡੀ ਗਰਾਊਂਡ ਫਲੋਰ 'ਤੇ ਹੈ ਕਿ ਫਸਟ ਫਲੋਰ 'ਤੇ ਹੈ ਓਕੇ ਜੀ ਅਤੇ ਮੈਮ ਸੀਲਿੰਗ ਡਿਜ਼ਾਈਨ ਦਾ ਵੀ ਬਹੁਤ ਵੱਡਾ ਇਫੈਕਟ ਹੈ ਇੰਟੀਰੀਅਰ ਡਿਜ਼ਾਇਨਿੰਗ ਦੇ ਉੱਤੇ ਹਾਂਜੀ ਹਾਂਜੀ ਡਾਊਨ ਸੀਲਿੰਗ ਹਾਂਜੀ ਹਾਂਜੀ ਡਾਊਨ ਸੀਲਿੰਗ ਕਰਵਾ ਕੇ ਆਪਾਂ ਉਸਨੂੰ ਬਹੁਤ ਹੀ ਵਧੀਆ ਇੱਕ ਲੁੱਕ ਦੇ ਸਕਦੇ ਹਾਂ ਅਤੇ ਇਹਦੇ ਨਾਲ ਘਰ ਬਹੁਤ ਲਿਸ਼ਕ ਜਾਂਦਾ ਹੈ ਅਤੇ ਨਵਾਂ ਨਵਾਂ ਵੀ ਲੱਗਦਾ ਹੈ ਉਸ ਦੇ ਵਿੱਚ ਆਪਾਂ ਵੱਖਰੀਆਂ ਵੱਖਰੀਆਂ ਲਾਈਟਾਂ ਵੀ ਲਗਾ ਸਕਦੇ ਹਾਂ ਠੀਕ ਹੈ ਮੈਮ ਓਕੇ ਮੈਮ ਓਕੇ ਜੀ ਥੈਂਕ ਯੂ